ਮਿਰਜਾ ਗੀਤ ਇੱਕ ਗੀਤ ਹੈ ਮੈਨੂੰ ਮਿਰਜਾ ਗੀਤ ਬਹੁਤ ਹੀ ਜਿਆਦਾ ਪਸੰਦ ਹੈ ਮੈਨੂੰ ਹਰਭਜਨ ਮਾਨ ਦਾ ਗਾਇਆ ਹੋਇਆ ਮਿਰਜਾ ਗੀਤ ਬਹੁਤ ਹੀ ਪਸੰਦ ਹੈ ਮਿਰਜਾ ਗੀਤ ਮਿਰਜਾ ਸਾਹਿਬ ਦੀ ਪ੍ਰੇਮ ਕਹਾਣੀ ਤੇ ਬਣਿਆ ਹੋਇਆ ਹੈ ਪਿਛਲੇ ਕਈ ਸਾਲ ਪਹਿਲਾਂ ਮਿਰਜੇ ਸਾਹਿਬ ਦਾ ਹੀ ਇੱਕ ਪੁਰਾਣੀ ਪ੍ਰੇਮ ਕਹਾਣੀ ਅਧੂਰੀ ਰਹਿ ਗਈ ਸੀ ਜਿਸ ਕਰਕੇ ਕਈ ਕਲਾਕਾਰਾਂ ਨੇ ਮਿਰਜਾ ਗੀਤ ਗਾਇਆ ਮਿਰਜਾ ਇੱਕ ਪਾਤਰ ਸੀ ਇਸੇ ਕਰਕੇ ਮੈਨੂੰ ਹਰਭਜਨ ਮਾਨ ਦਾ ਗੀਤ ਗਾਇਆ ਹੋਇਆ ਮਿਰਜਾ ਗੀਤ ਬਹੁਤ ਹੀ ਜਿਆਦਾ ਪਰੇਸੰਦ ਹੈ ਮਿਰਜਾ ਸਾਹਿਬਾ ਦੀ ਪ੍ਰੇਮ ਕਹਾਣੀ ਅਧੂਰੀ ਰਹਿ ਗਈ ਸੀ ਜਿਸ ਕਰਕੇ ਇਹ ਕਹਾਣੀ ਇਨੀ ਜਿਆਦਾ ਮਸ਼ਹੂਰ ਹੋਈ ਕਈ ਕਲਾਕਾਰਾਂ ਨੇ ਇਸ ਉੱਤੇ ਗੀਤ ਵੀ ਬਣਾਏ ਪ੍ਰੰਤੂ ਮੈਨੂੰ ਹਰਭਜਨ ਮਾਨ ਦਾ ਗੀਤ ਮਿਰਜਾ ਗਾਇਆ ਹੋਇਆ ਬਹੁਤ ਹੀ ਜਿਆਦਾ ਪਸੰਦ ਆਇਆ ਕਿਉਂਕਿ ਉਸ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਗੀਤ ਨੂੰ ਲੋਕਾਂ ਅੱਗੇ ਪੇਸ਼ ਕੀਤਾ ਜਿਸ ਕਰਕੇ ਹਰਭਜਨ ਮਾਨ ਇਸ ਗੀਤ ਨਾਲ ਹੋਰ ਵੀ ਜਿਆਦਾ ਮਸ਼ਹੂਰ ਹੋ ਗਿਆ ਸੀ ਇਸ ਵਿੱਚ ਇਹ ਵਿਲੱਖਣਤਾ ਹੈ ਕਿ ਮਿਰਜਾ ਗੀਤ ਦੀ ਜਿਹੜੀ ਕਹਾਣੀ ਸੀ ਉਹ ਅਧੂਰੀ ਰਹਿ ਗਈ ਸੀ ਜਿਸ ਕਰਕੇ ਇਹ ਗਾਣਾ ਬਹੁਤ ਹੀ ਜਿਆਦਾ ਮਸ਼ਹੂਰ ਹੋਇਆ ਸੀ